ਹੈਲੋ ਹਾਂਜੀ ਹਾਂਜੀ ਹਾਂਜੀ ਅਸੀਂ ਸਿਖਾਉਂਦੇ ਹਾਂ ਸਾਡੇ ਚਾਰਜਸ ਨੇ ਅਗਰ ਤਾਂ ਤੁਸੀਂ ਗਰੁੱਪ ਨਾਲ ਆਉਂਦੇ ਹੋ ਅਗਰ ਤੁਹਾਡੇ ਨਾਲ ਕੋਈ ਹੋਰ ਵੀ ਹੈਗਾ ਤੁਹਾਡਾ ਸਾਥੀ ਤਾਂ ਅਸੀਂ ਤੁਹਾਨੂੰ ਡਿਸਕਾਊਂਟ ਵੀ ਦੇਵਾਂਗੇ ਇੱਦਾਂ ਸਾਡਾ ਪ੍ਰਾਈਜ਼ ਹੈਗਾ ਆ ਸਾ ਸੱਤ ਸੌ ਰੁਪਇਆ ਮਹੀਨੇ ਦਾ ਅਗਰ ਤੁਸੀਂ ਆਪਣੇ ਨਾਲ ਕਿਸੇ ਦੋਸਤ ਨੂੰ ਵੀ ਲੈ ਕੇ ਆਉਂਦੇ ਹੋ ਤਾਂ ਅਸੀਂ ਤੁਹਾਨੂੰ ਔਫਰ ਦਿੰਦੇ ਹਾਂ ਕਿ ਤੁਹਾਡਾ ਮਹੀਨੇ ਦਾ ਪੰਜ ਸੌ ਰੁਪਇਆ ਲਵਾਂਗੇ ਹਾਂਜੀ ਅੱਛਾ ਓਕੇ ਹਾਂਜੀ ਸਾਡੇ ਟਾਈਮਿੰਗਸ ਨੇ ਕਿ ਅਸੀਂ ਸਵੇਰੇ ਵੀ ਕਰਵਾਉਂਦੇ ਹਾਂ ਅਤੇ ਸ਼ਾਮ ਨੂੰ ਵੀ ਕਰਵਾਉਂਦੇ ਹਾਂ ਸਵੇਰੇ ਸਾਡਾ ਟਾਈਮਿੰਗ ਹੋਏਗੀ ਛੇ ਤੋਂ ਅੱਠ ਵਜੇ ਤੱਕ ਅਤੇ ਸ਼ਾਮ ਨੂੰ ਅਸੀਂ ਟਾਈਮਿੰਗ ਸਾਡੇ ਹੁੰਦੇ ਨੇ ਚਾਰ ਤੋਂ ਛੇ ਵਜੇ ਤੱਕ ਤੁਹਾਨੂੰ ਜਿਹੜਾ ਵੀ ਟਾਈਮ ਸਹੀ ਲੱਗਦਾ ਤੁਸੀਂ ਆ ਸਕਦੇ ਹੋ ਹਾਂਜੀ ਕੋਈ ਦਿੱਕਤ ਓ ਆ ਅਸੀਂ ਉਹ ਕਰਵਾ ਲਵਾਂਗੇ ਅਸੀਂ ਤੁਹਾਡੇ ਟਾਈਮ ਦੇ ਅਕੋਰਡਿੰਗ ਤੁਹਾਨੂੰ ਟਾਈਮਿੰਗ ਦੇ ਦੇਵਾਂਗੇ ਜਿਹਦੇ ਵਿੱਚ ਤੁਸੀਂ ਆ ਸਕਦੇ ਹੋ ਸਾਡੀ ਕਲਾਸਿਸ ਅਟੈਂਡ ਕਰ ਸਕਦੇ ਹੋ ਹਾਂਜੀ ਹਾਂਜੀ ਸਾਡਾ ਜਿਹੜਾ ਯੋਗਾ ਕਲਾਸਿਸ ਐਹੈ ਇਹ ਬਹੁਤ ਵਧੀਆ ਚੱਲ ਰਹੀ ਹੈ ਸਾਡੇ ਇੱਥੇ ਕਈ ਲੋਕ ਕਰ ਕੇ ਗਏ ਨੇ ਅਤੇ ਕਾਫੀ ਫਿੱਟ ਰਹੇ ਨੇ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਭੇਜਦੇ ਹੋ ਤਾਂ ਉਹਨਾਂ ਦੀ ਵੀ ਵਿਕਾਸ ਵਿਚ ਕਾਫੀ ਮਦਦਕਾਰ ਹੋਏਗਾ ਸਾਡਾ ਯੋਗਾ ਸੈਂਟਰ

ਹਾਂਜੀ ਓਕੇ ਧੰਨਵਾਦ ਜੀ